ਦੋ ਹਜ਼ਾਰ ਪੰਜ ਸੌ ਚਾਲੀ ਚਾਲੀ ਹਜ਼ਾਰ ਪੰਜ ਸੌ ਛੇ ਤਿੰਨ ਲੱਖ ਚਾਰ ਹਜ਼ਾਰ ਪੰਜ ਸੌ ਅੱਸੀ ਪੰਜ ਲੱਖ ਵੀਹ ਹਜ਼ਾਰ ਪੰਜ ਸੌ ਚਾਲੀ ਛੇ ਲੱਖ ਪੰਜਾਹ ਹਜ਼ਾਰ ਸੱਤ ਸੌ ਵੀਹ